ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਸਿੰਘ ਗੱਲ ਕਰ ਰਿਹਾ ਜੀ ਐੱਸ ਬੀ ਹਿਮਾਚਲੀ ਢਾਬੇ ਤੋਂ ਗੱਲ ਕਰ ਰਹੇ ਹੋ ਤੁਸੀਂ ਐਕਚੁਲੀ ਸਰ ਮੈਂ ਥੋੜ੍ਹੇ ਟਾਈਮ ਪਹਿਲਾਂ ਔਡਰ ਪਲੇਸ ਕੀਤਾ ਸੀਗਾ ਜਿਸ ਵਿੱਚ ਦਾਲ ਫਰਾਈ ਦਾਲ ਮੱਖਣੀ ਸੇ ਭਾਜੀ ਆਲੂ ਗੋਭੀ ਮਿਕਸ ਵੈੱਜ ਚਨਾ ਮਸਾਲਾ ਸ਼ਾਹੀ ਪਨੀਰ ਕੜਾਈ ਪਨੀਰ ਪਨੀਰ ਭੁਰਜੀ ਅਤੇ ਨਾਲ ਤੰਦੂਰੀ ਰੋਟੀ ਅਤੇ ਤੰਦੂਰੀ ਪਰਾਂਠੇ ਔਡਰ ਕੀਤੇ ਸੀ ਨਾਲ ਕੋਲਡ ਡਰਿੰਕਾਂ ਵੀ ਤੁਹਾਨੂੰ ਕਿਹਾ ਸੀ ਦੋ ਦੋ ਲੀਟਰ ਦੀਆਂ ਕਿਉਂਕਿ ਤਿੰਨ ਕੋਲਡ ਡਰਿੰਕਾਂ ਭੇਜ ਦਿਓ ਅਤੇ ਤੁਸੀਂ ਸਰ ਜਿਹੜਾ ਨੰਬਰ ਦਿੱਤਾ ਸੀ ਮੈਨੂੰ ਡਿਲੀਵਰੀ ਬੋਆਏ ਦਾ ਕਿ ਡਿਲੀਵਰੀ ਬੋਆਏ ਟਾਈਮ ਦੇ ਨਾਲ ਤੁਹਾਡਾ ਔਡਰ ਡਿਲੀਵਰ ਕਰ ਦੇਗਾ ਅਤੇ ਉਹ ਡਿਲੀਵਰੀ ਬੋਆਏ ਕੋਲ ਨਹੀਂ ਅਟੈਂਡ ਕਰ ਰਿਹਾ ਹੁਣ ਤੁਸੀਂ ਦੱਸੋ ਮੇਰਾ ਔਡਰ ਨਹੀਂ ਪਲੇਸ ਹੋਇਆ ਜਾਂ ਮੇਰਾ ਔਡਰ ਪਲੇਸ ਹੋ ਗਿਆ ਅਤੇ ਉਹ ਕਦੋਂ ਤੱਕ ਪਹੁੰਚੇਗਾ ਅਤੇ ਜਲਦੀ ਤੋਂ ਜਲਦੀ ਪਲੀਜ਼ ਰਿਕੁਐਸਟ ਹੈ ਕਿ ਮੇਰਾ ਔਡਰ ਪਜਾਇਆ ਜਾਵੇ ਘਰ ਵਿੱਚ ਗੈਸਟ ਆਏ ਹੋਏ ਹਨ ਅਤੇ ਇਸ ਲਈ ਪਲੀਜ਼ ਮੇਰਾ ਔਡਰ ਜਲਦੀ ਤੋਂ ਜਲਦੀ ਪਜਾਇਆ ਜਾਵੇ ਨਹੀਂ ਤੁਹਾਨੂੰ ਪਤਾ ਕਿ ਢਾਬੇ ਦਾ ਜਿਹੜਾ ਆਪਾਂ ਫੀਡਬੈਕ ਸਟਾਰ ਦੇਣੇ ਆ ਉਹ ਆਪਾਂ ਫਿਰ ਫੀਡਬੈਕ ਗਲਤ ਏ ਦਵਾਂਗੇ ਜੀ ਉਹਦਾ ਕਿਉਂਕਿ ਕਸਟਮਰ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਅਤੇ ਇਹ ਬੇਨਤੀ ਹੈ ਸਰ ਪਲੀਜ਼ ਜਲਦੀ ਤੋਂ ਜਲਦੀ ਔਡਰ ਭੇਜ ਦਿਓ ਜੀ ਓਕੇ ਸਰ ਧੰਨਵਾਦ ਜੀ